ਕਿਸੇ ਵੀ ਪ੍ਰਕਾਰ ਦੀ ਸਰੀਰਕ ਸਿਖਲਾਈ ਦੇ ਲਈ ਪੋਸ਼ਣ ਬਹੁਤ ਜ਼ਰੂਰੀ ਹੈ ਕਿਉਂਕਿ ਬਿਨਾਂ ਪੋਸ਼ਣ ਤੋਂ ਸਾਡਾ ਸਰੀਰ ਕੰਮ ਨਹੀਂ ਕਰ ਸਕਦਾ ਅਤੇ ਜੇਕਰ ਅਸੀਂ ਗਰਾਉਂਡ ਦੇ ਵਿੱਚ ਪ੍ਰੈਕਟਿਸ ਕਰ ਰਹੇ ਹੈ ਉਸਦੇ ਲਈ ਤਾਂ ਸਾਨੂੰ ਡਬਲ ਪੋਸ਼ਣ ਦੀ ਜ਼ਰੂਰਤ ਹੁੰਦੀ ਹੈ ਘਰ ਦੇ ਕੰਮਾਂ ਦੇ ਵਿੱਚ ਤਾਂ ਇੰਨਾਂ ਕੰਮ ਨਹੀਂ ਹੁੰਦਾ ਕਿ ਅਸੀਂ ਬਹੁਤ ਜ਼ਿਆਦਾ ਡਾਈਟ ਲਈਏ ਪਰੰਤੂ ਜੇਕਰ ਅਸੀ ਗਰਾਉਂਡ ਦੇ ਵਿੱਚ ਸਿਖਲਾਈ ਲੈ ਰਹੇ ਹਾਂ ਦੌੜ ਰਹੇ ਹਾਂ ਕੁੱਦ ਰਹੇ ਹਾਂ ਉਸਦੇ ਲਈ ਸਪੈਸ਼ਲ ਡਾਈਟ ਦੀ ਲੋੜ ਹੁੰਦੀ ਹੈ ਕਿਉਂਕਿ ਸਾਡੇ ਸਰੀਰ ਉਸ ਟਾਈਮ ਬਹੁਤ ਜ ਸਾਡੇ ਸਰੀਰ ਤੋਂ ਅਸੀਂ ਬਹੁਤ ਕੰਮ ਲੈਂਦੇ ਹੈ ਉਸੀ ਤਰ੍ਹਾਂ ਆਪਣੇ ਸਰੀਰ ਨੂੰ ਦੇਣਾ ਵੀ ਬਹੁਤ ਜ਼ਰੂਰੀ ਹੈ ਦੇਣ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਅਸੀਂ ਫਾਸਟ ਫੂਡ ਖਾਈਏ ਨਿਊਡਲ ਬਰਗਰ ਵਗੈਰਾ ਖਾਈਏ ਮਤਲਬ ਕਿ ਦੁੱਧ ਪੀਣਾ ਔਰ ਕਾਜੂ ਬਦਾਮ ਘਰ ਦੀ ਰੋਟੀ ਖਾਣਾ ਜੋ ਕਿ ਸਾਡੇ ਸਰੀਰ ਲਈ ਬਹੁਤ ਲਾਭਫੁਲ ਹੁੰਦੇ ਹਨ ਹੁਣ ਮੈਂ ਵੀ ਇੱਕ ਖਿਡਾਰੀ ਹਾਂ ਇਸ ਕਰਕੇ ਮੈਨੂੰ ਪਤਾ ਏ ਸਾਡੇ ਅਧਿਆਪਕ ਸਾਨੂੰ ਦੱਸਦੇ ਸਨ ਕਿ ਕਿਹੋ ਜਿਹੀ ਡਾਈਟ ਲੈਣੀ ਚਾਹੀਦੀ ਹੈ ਸਵੇਰੇ ਸ਼ਾਮ ਸਵੇਰੇ ਦੁੱਧ ਦੁੱਧ ਦੇ ਨਾਲ ਕੇਲਾ ਲੈ ਲਿਆ ਪ੍ਰੈਕਟਿਸ ਤੋਂ ਘੰਟਾ ਪਹਿਲਾਂ ਜੋ ਕਿ ਸਾਡੇ ਸਾਡੇ ਸਰੀਰ ਨੂੰ ਸਰੀਰ ਦੇ ਵਿੱਚ ਹਾਈਡ੍ਰੇਸ਼ਨ ਪੈਦਾ ਕਰਦਾ ਹੈ ਅਤੇ ਦੋੜਣ ਦੇ ਉਪਰੰਤ ਇੱਕਦਮ ਪਾਣੀ ਨਹੀਂ ਪੀਣਾ ਚਾਹੀਦਾ ਕੁਛ ਸਮੇਂ ਰੈਸਟ ਕਰਕੇ ਸਰੀਰ ਜੇ ਜਦੋ ਠੰਡਾ ਹੋ ਜਾਵੇ ਉਦੋਂ ਪਾਣੀ ਪੀਣਾ ਚਾਹਿਦਾ ਹੈ ਕਿਉਂਕਿ ਸਾਡੇ ਸਰੀਰ ਦੇ ਵਿੱਚ ਇਸ ਨਾਲ ਕਈ ਪ੍ਰਕਾਰ ਦੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਦੋੜਣ ਦੇ ਸਮੇਂ ਲਗਾ ਲਗਾਤਾਰ ਫਾਸਟ ਸਪੀਡ ਅਤੇ ਸਲੋ ਸਪੀਡ ਨਹੀਂ ਕਰਨੀ ਚਾਹੀਦੀ ਇਸਦੇ ਨਾਲ ਵੀ ਕਾਫੀ ਦਿੱਕਤ ਆ ਸਕਦੀ ਹੈ ਪਾਣੀ ਪਾਣੀ ਵੀ ਪੂਰਾ ਦਾ ਪੂਰਾ ਲੈਣਾ ਚਾਹੀਦਾ ਹੈ ਦਿਨ ਦੇ ਵਿੱਚ ਲਗਭਗ ਦੋ ਲੀਟਰ ਪਾਣੀ ਤਾਂ ਪੀਣਾ ਹੀ ਚਾਹੀਦਾ ਹੈ ਇੱਕ ਇੱਕ ਗਲਾਸ ਕਰਕੇ ਘੰ ਇੱਕ ਘੰਟੇ ਦੇ ਵਿੱਚ ਇੱਕ ਪੀ ਲਿਆ ਇਸਦੇ ਨਾਲ ਸਾਡੇ ਸਰੀਰ ਵਿੱਚ ਹਾਈਡ੍ਰੇਸ਼ਨ ਬਣੀ ਰਹਿੰਦੀ ਹੈ ਚੱਕਰ ਆਉਣ ਦੀ ਸਮੱਸਿਆ ਘੱਟਦੀ ਹੈ ਅਤੇ ਸਟੈਮੀਨਾ ਵੀ ਕਾਫੀ ਵੱਧਦਾ ਹੈ ਦੋੜਣ ਦੇ ਵਿੱਚ ਆਸਾਨੀ ਹੁੰਦੀ ਹੈ